ਸਾਡੇ ਰਾਜ ਵਿੱਚ ਕਈ ਪ੍ਰਮੁੱਖ ਧਾਰਮਿਕ ਸਖਸ਼ੀਅਤਾਂ ਹੈਗੀਆਂ ਨੇ ਜਿਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਸਿੱਖ ਧਰਮ ਦੇ ਜੋ ਦਸ ਗੁਰੂ ਹੋਏ ਨੇ ਉਹਨਾਂ ਨੂੰ ਜਾਣੀ ਕਿ ਸਤਿਕਾਰਿਆ ਜਾਂਦਾ ਹੈ ਉਹ ਤਾਂ ਜਾਣੀ ਕਿ ਸਿਰਫ਼ ਸਿੱਖ ਧਰਮ 'ਚ ਨਹੀਂ ਬਾਕੀ ਸਾਰੇ ਧਰਮਾਂ ਵੱਲੋਂ ਵੀ ਉਹ ਗੁਰੂ ਸਤਿਕਾਰੇ ਗਏ ਨੇ ਅਤੇ ਉਸ ਤੋਂ ਇਲਾਵਾ ਸਾਡੇ ਅੱਜ ਦੇ ਗਿਆਰ੍ਹਵੇਂ ਗੁਰੂ ਸਿੱਖ ਧਰਮ ਦੇ ਜੱਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਸਿੱਖ ਧਰਮ ਵੱਲੋਂ ਸਤਿਕਾਰ ਯੋਗ ਗੁਰੂ ਮੰਨ ਕੇ ਜਿਹਨਾਂ ਨੂੰ ਕਿ ਉਹਨਾਂ ਦੇ ਆਦਰਸ਼ਾਂ ਦੇ ਅਨੁਸਾਰ ਜੀਵਨ ਬਤੀਤ ਕੀਤਾ ਜਾਂਦਾ